ਸਾਡੇ ਆਂਢ ਗੁਆਂਢ ਵਿੱਚ ਹੋਮਸਟੇ ਸੈਲਾਨੀਆਂ ਲਈ ਬਹੁਤ ਸਾਰੀਆਂ ਸਹੂਲਤਾਂ ਹਨ ਅਤੇ ਬਹੁਤ ਸਾਰੇ ਸੈਲਾਨੀ ਆਉਂਦੇ ਹਨ ਅਤੇ ਇੱਥੇ ਕਈ ਅਜਿਹੇ ਹੋਮਸਟੇ ਘਰ ਵੀ ਬਣਾਏ ਗਏ ਹਨ ਜਿਹਨਾਂ ਵਿੱਚ ਗਰਮੀਆਂ ਵਿੱਚ ਏ ਸੀ ਪੱਖੇ ਵਗੈਰਾ ਲਗਾਏ ਜਾਂਦੇ ਹਨ ਅਤੇ ਉਹਨਾਂ ਨੂੰ ਰਹਿਣ ਲਈ ਕੰਬਲ ਬਿਸਤਰੇ ਸਭ ਕਾਸੇ ਦਾ ਅਰੇਂਜਮੈਂਟ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਖਾਣ ਪੀਣ ਦਾ ਵੀ ਜਦੋਂ ਕਿ ਹੋਰ ਵੀ ਕਈ ਹੋਟਲ ਵੀ ਹਨ ਜਿਨ੍ਹਾਂ ਵਿੱਚ ਉਹ ਲੋਕ ਰਹਿ ਸਕਦੇ ਹਨ ਜਿਹੜੇ ਕਿ ਹੋਟਲ ਨੂੰ ਹੋਟਲ ਵਿੱਚ ਰਹਿਣਾ ਅਫੋਰਡ ਕਰ ਸਕਦੇ ਹਨ ਕਈ ਲੋਕ ਜ਼ਿਆਦਾਤਰ ਧਰਮਸ਼ਾਲਾ ਵਿੱਚ ਰਹਿੰਦੇ ਹਨ ਜਿੱਥੇ ਵੀ ਜਿੱਥੇ ਲੋਕ ਮੁਫਤ ਰਹਿੰਦੇ ਹਨ ਉਹਨਾਂ ਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਹੁੰਦੀ ਅਤੇ ਉਹਨਾਂ ਨੂੰ ਉੱਥੇ ਹਰ ਤਰ੍ਹਾਂ ਦੀ ਸਹੂਲੀਅਤ ਪ੍ਰਦਾਨ ਹੁੰਦੀ ਹੈ